ਸਤਿ ਸ਼੍ਰੀ ਅਕਾਲ ਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਪਰ ਬਹੁਤ ਸਾਰੇ ਪਲੇਟਫਾਰਮ ਉਪਲਬਧ ਹਨ ਜਿਵੇਂ ਕਿ ਇੰਸਟਾਗਰਾਮ ਫੇਸਬੁਕ ਵਟਸਐਪ ਟਵਿਟਰ ਟਿਕਟੌਕ ਸਨੈਪਚੈਟ ਯੂਟਿਊਬ ਪਿੰਟਰੈਸਟ ਆਦਿ ਮੈਂ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਦੇ ਉੱਪਰ ਬਰਬਾਦ ਨਹੀਂ ਕਰਦੀ ਪਰ ਫਿਰ ਵੀ ਅਗਰ ਮੈਂ ਕਦੇ ਕੋਈ ਪੋਸਟ ਕਰਨਾ ਹੋਵੇ ਕਦੇ ਮੈਨੂੰ ਕੁਛ ਜ਼ਰੂਰੀ ਕੰਮ ਹੋਵੇ ਤਾਂ ਮੈਂ ਵਟਸਐਪ ਦਾ ਇਸਤੇਮਾਲ ਕਰਦੀ ਹਾਂ ਕਿਉਂਕਿ ਵਟਸਐਪ ਦੇ ਵਿੱਚ ਸਿਰਫ ਉਹੀ ਬੰਦੇ ਤੁਹਾਡੀ ਪੋਸਟ ਦੇਖਣਗੇ ਜੋ ਕਿ ਤੁਹਾਡੀ ਕੰਟੈਕਟ ਲਿਸਟ ਦੇ ਵਿੱਚ ਮੌਜੂਦ ਹਨ ਜਿਵੇਂ ਕਿ ਵਟਸਐਪ ਉੱਪਰ ਸਟੇਟਸ ਲਗਾਇਆ ਜਾਂਦਾ ਹੈ ਤਾਂ ਉਹ ਚੌਵੀ ਘੰਟਿਆਂ ਤੋਂ ਬਾਅਦ ਖੁਦ ਹੀ ਹਟ ਜਾਂਦਾ ਹੈ ਉਸ ਨੂੰ ਸਿਰਫ ਉਹ ਹੀ ਲੋਕ ਦੇਖ ਸਕਦੇ ਹਨ ਜੋ ਕਿ ਤੁਹਾਡੀ ਕੋਂਟੈਕਟ ਲਿਸਟ ਦੇ ਵਿੱਚ ਮੌਜੂਦ ਹਨ ਜੇਕਰ ਤੁਸੀਂ ਸਟੇਟਸ ਨੂੰ ਸਮੇਂ ਤੋਂ ਪਹਿਲਾਂ ਹਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਵਟਸਐਪ ਤੁਹਾਨੂੰ ਟੈਕਸਟ ਮੈਸੇਜ ਤਸਵੀਰਾਂ ਸ਼ੇਅਰ ਕਰਨ ਵੀਡੀਓ ਸ਼ੇਅਰਿੰਗ ਅਤੇ ਸਟੇਟਸ ਲਗਾਉਣ ਦੀ ਸੁਵਿਧਾ ਉਪਲਬਧ ਕਰਾਉਂਦਾ ਹੈ ਵਟਸਐਪ ਉੱਪਰ ਮੈਂ ਪੋਸਟ ਉਦੋਂ ਹੀ ਕਰਦੀ ਹਾਂ ਜਦੋਂ ਮੈਂ ਕੋਈ ਆਪਣੀ ਖੁਸ਼ੀ ਸਾਂਝੀ ਕਰਨੀ ਹੋਵੇ ਜਾਂ ਫਿਰ ਕਿਸੇ ਨੂੰ ਕਿਸੇ ਖ਼ਾਸ ਦਿਨ 'ਤੇ ਵਿਸ਼ ਕਰਨਾ ਹੋਵੇ ਜੇਕਰ ਮੈਂ ਕੋਈ ਖ਼ਾਸ ਪ੍ਰੋਗਰਾਮ ਅਟੈਂਡ ਕੀਤਾ ਹੋਵੇ ਉਸ ਦੇ ਬਾਰੇ ਸਾਰਿਆਂ ਨੂੰ ਦੱਸਣਾ ਹੋਵੇ ਤਾਂ ਮੈਂ ਉਹ ਵੀ ਵਟਸਐਪ ਉੱਪਰ ਪੋਸਟ ਕਰਦੀ ਹਾਂ ਧੰਨਵਾਦ ਜੀ